ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਮਤਲਬ ਸੈਲਫਲੈਸ ਸਰਵਿਸ ਹੈਗੀ ਜਿਹੜੇ ਸਾਡੇ ਧਰਮ ਦੇ ਵਿੱਚ ਮਤਲਬ ਇੱਥੇ ਲੋਕਾਂ ਦੇ ਨਾਲ਼ ਹਰ ਇੱਕ ਧਰਮ ਦੇ ਲੋਕਾਂ ਦੇ ਨਾਲ਼ ਚੰਗਾ ਬੀਹੇਵੀਅਰ ਕੀਤਾ ਜਾਂਦਾ ਗਾ ਇੱਥੇ ਕੋਵਿਡ ਦੇ ਵਿੱਚ ਵੀ ਜਿਹੜੇ ਮਤਲਬ ਲੰਗਰ ਚਲਾਏ ਗਏ ਆ ਗੇ ਕੋਈ ਵੀ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਕੇ ਮਤਲਬ ਗੁਰਦੁਆਰਿਆਂ ਦੇ ਵਿੱਚ ਰਹਿ ਸਕਦਾ ਗਾ ਲੰਗਰ ਛੱਕ ਸਕਦਾ ਗਾ ਤਾਂ ਜਿਹੜੇ ਸਾਡੇ ਧਰਮ ਦੇ ਵਿੱਚ ਦੂਜੇ ਲੋਕਾਂ ਦੇ ਨਾਲ਼ ਮਿਲ ਜੁਲ ਕੇ ਰਹਿਣ ਦਾ ਜਿਹੜਾ ਸੰਦੇਸ਼ ਦਿੱਤਾ ਗਿਆ